ਘੁੰਮਣ ਫਿਰਨ ਵਿੱਚ ਮੈਨੂੰ ਬਹੁਤ ਹੀ ਮਜ਼ਾ ਆਉਂਦਾ ਹੈ ਅਤੇ ਮੈਂ ਘੁੰਮ ਫਿਰ ਕੇ ਬਹੁਤ ਖੁਸ਼ ਹਾਂ ਮੈਂ ਵਾਹਗਾ ਬਾਰਡਰ 'ਤੇ ਵੀ ਦੋ ਵਾਰ ਗਿਆ ਹਾਂ ਜੋ ਕਿ ਅੰਮ੍ਰਿਤਸਰ ਹੈ ਅਤੇ ਉਹ ਬਾਰਡਰ ਪਾਕਿਸਤਾਨ ਨਾਲ ਟੱਚ ਕਰਦਾ ਹੈ ਅਤੇ ਮੈਂ ਉੱਥੋਂ ਦੀ ਪਰੇਡ ਵੀ ਦੇਖੀ ਹੈ ਦੋਨੋਂ ਵਾਰ ਸੌ ਉਹ ਜਦੋਂ ਸਿਪਾਹੀ ਪਰੇਡ ਕਰਦੇ ਹਨ ਤਾਂ ਬੜੇ ਜੋਸ਼ ਅਤੇ ਜਜਬ ਨਾਲ ਕਰਦੇ ਹਨ ਸੋ ਉੱਥੇ ਲੋਕਾਂ ਦਾ ਬਹੁਤ ਹੀ ਕਰਾਊਡ ਹੁੰਦਾ ਹੈ ਅਤੇ ਲੋਕ ਉਹਨਾਂ ਦਾ ਤਾੜੀਆਂ ਮਾਰ ਮਾਰ ਬੜਾ ਉਤਸ਼ਾਹ ਵਧਾਉਂਦੇ ਹਨ ਮੈਂ ਚੰਡੀਗੜ੍ਹ ਵੀ ਘੁੰਮਿਆ ਹਾਂ ਜਿਵੇਂ ਕਿ ਉੱਥੇ ਸਤਾਰਾਂ ਸੈਕਟਰ ਅਲਾਤੇ ਮੌਲ ਬਾਈ ਦੀ ਮਾਰਕੀਟ ਇਹ ਬੜੀਆਂ ਮਸ਼ਹੂਰ ਹਨ ਸੋ ਮੈਂ ਉੱਥੇ ਦੋ ਤਿੰਨ ਮਹੀਨਿਆਂ ਬਾਅਦ ਇੱਕ ਵਾਰ ਮੇਰਾ ਜ਼ਰੂਰ ਚੱਕਰ ਲੱਗਦਾ ਹੈ ਅਤੇ ਮੈਨੂੰ ਉੱਥੇ ਘੁੰਮ ਕੇ ਬੜਾ ਹੀ ਮਜ਼ਾ ਆਉਂਦਾ ਹੈ ਬਾਈ ਦੀ ਮਾਰਕੀਟ ਵਿੱਚ ਤਾਂ ਬਹੁਤ ਹੀ ਸਸਤੀਆਂ ਚੀਜ਼ਾਂ ਮਿਲਦੀਆਂ ਹਨ ਅਤੇ ਮੈਂ ਰੋਹਤਾਂਗ ਵੀ ਗਿਆ ਹਾਂ ਰੋਹਤਾਂਗ ਵੀ ਕਾਫ਼ੀ ਉਚਾਈ ਦੇ ਉੱਤੇ ਹੈ ਹਿਮਾਚਲ ਵਿੱਚ ਪੈਂਦਾ ਹੈ ਉੱਥੇ ਇੱਕ ਝਰਨਾ ਵਗਦਾ ਹੈ ਜੋ ਝਰਨਾ ਬੜਾ ਹੀ ਮਨਮੋਹ ਲੈਂਦਾ ਹੈ ਅਤੇ ਉੱਥੇ ਵੀ ਬਹੁਤ ਹੀ ਕਰਾਊਡ ਹੁੰਦਾ ਹੈ ਅਤੇ ਉੱਥੇ ਜਾ ਕੇ ਵੀ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਅਤੇ ਇੱਕ ਵਾਰ ਮੈਂ ਚਿੰਤਪੁਰਨੀ ਵੀ ਗਿਆ ਹਾਂ ਚਿੰਤਪੁਰਨੀ ਵੀ ਮਾਤਾ ਦੇ ਦਰਸ਼ਨ ਕਰਕੇ ਬੜਾ ਦਿਲ ਨੂੰ ਸਕੂਨ ਮਿਲਦਾ ਹੈ ਅਤੇ ਬਹੁਤ ਹੀ ਵਧੀਆ ਦਰਸ਼ਨ ਹੋਏ ਅਤੇ ਉਸ ਤੋਂ ਬਾਅਦ ਮੈਂ ਇੱਕ ਵਾਰ ਜਲੰਧਰ ਵੀ ਗਿਆ ਸੀ ਜਲੰਧਰ ਸਨ ਸਿਟੀ ਦੇ ਵਿੱਚ ਮੈਂ ਗਿਆ ਸੀਗਾ ਅਤੇ ਜਲੰਧਰ ਹਵੇਲੀ ਦੇ ਵਿੱਚ ਵੀ ਮੈਂ ਗਿਆ ਸੀ ਅਸੀਂ ਉੱਥੇ ਵੀ ਬਹੁਤ ਵਧੀਆ ਖਾਣਾ ਖਾਂਦਾ ਜਲੰਧਰ ਵੈਸੇ ਖਾਣ ਪੀਣ ਦੇ ਮਾਮਲੇ ਦੇ ਵਿੱਚ ਜ਼ਿਆਦਾ ਜਾਣਿਆ ਜਾਂਦਾ ਹੈ ਫਿਰ ਮੈਂ ਅੰਮ੍ਰਿਤਸਰ ਗਿਆ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਖਾਣ ਪੀਣ ਦੇ ਮਾਮਲਿਆਂ ਦੇ ਵਿੱਚ ਬਹੁਤ ਜ਼ਿਆਦਾ ਜਾਣਿਆ ਜਾਂਦਾ ਹੈ ਦਰਬਾਰ ਸਾਹਿਬ ਜਦੋਂ ਵੀ ਜਾਈਦਾ ਮਨ ਨੂੰ ਬੜਾ ਸਕੂਨ ਮਿਲਦਾ ਹੈ ਅਤੇ ਦਰਬਾਰ ਸਾਹਿਬ ਸਾਰਾ ਹੀ ਸੋਨੇ ਦਾ ਬਣਿਆ ਹੋਇਆ ਹੈ ਅਤੇ ਦਰਬਾਰ ਸਾਹਿਬ ਦੇ ਵਿੱਚ ਕਹਿ ਲਓ ਗੋਲਡਨ ਟੈਂਪਲ ਉੱਥੇ ਚੌਵੀ ਘੰਟੇ ਹੀ ਲੰਗਰ ਚੱਲਦਾ ਰਹਿੰਦਾ ਹੈ ਇਹ ਬੜੀ ਹੀ ਵਧੀਆ ਗੱਲ ਹੈ ਦਰਬਾਰ ਸਾਹਿਬ ਦੀ ਅਤੇ ਮੈਂ ਜਲੰਧਰ ਦੇ ਵਿੱਚ ਮੰਦਿਰ ਵੀ ਦੇਖੇ ਨੇ ਕਾਫ਼ੀ ਵੱਡੇ ਵੱਡੇ ਉਹ ਵੀ ਬਹੁਤ ਹੀ ਵਧੀਆ ਨੇ ਅਤੇ ਮੈਂ ਆਪਣੇ ਸ਼ਹਿਰ ਬਠਿੰਡਾ ਵੀ ਘੁੰਮਿਆ ਹਾਂ ਸਾਡਾ ਬਠਿੰਡਾ ਸ਼ਹਿਰ ਵੀ ਝੀਲਾਂ ਦਾ ਸ਼ਹਿਰ ਵੱਸਦਾ ਹੈ ਅਤੇ ਇੱਥੇ ਮੌਲਵੀ ਹਨ ਅਤੇ ਝੀਲਾਂ ਵੀ ਹਨ ਅਤੇ ਝੀਲਾਂ ਦੇ ਵਿੱਚ ਕਿਸ਼ਤੀਆਂ ਵੀ ਚੱਲਦੀਆਂ ਹਨ ਅਤੇ ਅਸੀਂ ਵੀ ਕਿਸ਼ਤੀਆਂ ਦੇ ਵਿੱਚ ਸਵਾਰ ਹੋ ਕੇ ਝੂਟੇ ਲਏ ਸਨ